ਜਿਹੜੇ ਲੋਕ ਅੱਜ ਦੇ ਟਾਈਮ ਵਿੱਚ ਕਾਰੋਬਾਰ ਨਾਲ ਜੁੜੇ ਹੋਏ ਹਨ ਉਹ ਬਹੁਤ ਹੀ ਲਾਭ ਲੈ ਰਹੇ ਹਨ ਡਿਜ਼ੀਟਲਲਾਈਜ਼ੇਸ਼ਨ ਡਿਜ਼ੀਟਲਲਾਈਜ਼ੇਸ਼ਨ ਤੋਂ ਭਾਵ ਕਿ ਕੁਝ ਵੀ ਟ੍ਰਾਂਜੈਕਸ਼ਨ ਔਨਲਾਈਨ ਜਾਂ ਫਿਰ ਔਨਲਾਈਨ ਤੋਂ ਬਾਅਦ ਜਿਵੇਂ ਕਿ ਪੈਸਾ ਇੰਨਵੈਸਟ ਕਰਨਾ ਜਾਂ ਪੈਸਾ ਕਢਵਾਉਣਾ ਕੰਪਨੀਆਂ ਨੇ ਅੱਜ ਕੱਲ੍ਹ ਇਹ ਚੀਜ਼ ਵੀ ਔਨਲਾਈਨ ਕਰ ਦਿੱਤੀ ਹੈ ਜਿਵੇਂ ਕਿ ਕੰਪਨੀ ਕੋਈ ਵੀ ਆਪਣਾ ਸਮਾਨ ਪ੍ਰੋਡਕਟ ਬਣਾਉਂਦੀ ਹੈ ਉਹ ਔਨਲਾਈਨ ਪਾ ਦਿੰਦੀ ਹੈ ਜਿਸ ਨਾਲ ਆਮ ਆਦਮੀ ਜਿਵੇਂ ਕਿ ਕਿਸਾਨ ਵਗੈਰਾ ਉਸ ਦੇ ਦੇਖਦੇ ਹਨ ਅਤੇ ਖਰੀਦ ਲੈਂਦੇ ਹਨ ਜਿਸ ਕਾਰਨ ਕਿਸਾਨਾਂ ਦਾ ਟਾਈਮ ਬਚਦਾ ਕਿਉਕਿ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਸਮਾਨ ਦੂਰ ਦੂਰ ਤੋਂ ਲੈ ਕੇ ਆਉਣਾ ਪੈਂਦਾ ਹੈ ਇਸ ਤਕਨੀਕ ਨਾਲ ਉਨ੍ਹਾਂ ਨੂੰ ਸਮਾਨ ਘਰ ਪਹੁੰਚ ਜਾਦਾ ਹੈ ਅਤੇ ਇਹ ਬਹੁਤ ਹੀ ਟਾਈਮ ਕੰਜ਼ਿਊਮਿੰਗ ਨਹੀਂ ਹੈ ਇਸ 'ਚ ਬਹੁਤ ਹੀ ਘੱਟ ਟਾਈਮ ਲੱਗਦਾ ਹੈ ਜਿਵੇਂ ਕਿ ਅਗਰ ਆਪਾਂ ਅੱਜ ਕਿਸੇ ਚੀਜ਼ ਨੂੰ ਔਡਰ ਕਰਾਂਗੇ ਤਾਂ ਉਹ ਸਾਡੇ ਕੋਲ ਦੋ ਜਾਂ ਤਿੰਨ ਦਿਨ ਤੱਕ ਪਹੁੰਚ ਜਾਏਗੀ ਇਸਦਾ ਬਹੁਤ ਫਾਇਦਾ ਹੈ ਅਤੇ ਅੱਜ ਦੇ ਲੋਕ ਇਸਦਾ ਫਾਇਦਾ ਬਹੁਤ ਹੀ ਵਧੀਆ ਤਰੀਕੇ ਨਾਲ ਚੱਕ ਰਹੇ ਹਨ ਇਹ ਬਹੁਤ ਹੀ ਲਾਭਦਾਇਕ ਹੈ